ਜੇਕਰ ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਆਪਾਂ ਗੱਲ ਕਰੀਏ ਤਾਂ ਭਾਰਤ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਜ਼ਿਆਦਾ ਬੇਕਾਰ ਸਿਸਟਮ ਚੱਲ ਰਿਹਾ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਸਟੂਡੈਂਟ ਦੇ ਬੱਚਿਆਂ 'ਤੇ ਬੜਾ ਗਲਤ ਅਸਰ ਪੈਂਦਾ ਹੈ ਅੱਜਕੱਲ ਦੇ ਬੱਚੇ ਭਾਰਤ ਵਿੱਚ ਪੜ੍ਹਨ ਦੀ ਬਜਾਏ ਵਿਦੇਸ਼ਾਂ ਵਿੱਚ ਜ਼ਿਆਦਾ ਪੜ੍ਹਨਾ ਤਰਜੀਹ ਦਿੰਦੇ ਹਨ ਕਿਉਂਕਿ ਉੱਥੋਂ ਦੀ ਪੜ੍ਹਾਈ ਬਹੁਤ ਹੀ ਵਧੀਆ ਹੈ ਅਤੇ ਉੱਥੋਂ ਪੜ੍ਹਾਇਆ ਹੋਇਆ ਸਮਝਣਾ ਵੀ ਬੜਾ ਤਰੀਕੇ ਆਸਾਨ ਹੈ ਜਿਹੜੀ ਭਾਰਤ ਦੀ ਸਿਸਟਮ ਹੈ ਭਾਰਤ ਦੇ ਵਿੱਚ ਜ਼ਿਆਦਾਤਰ ਤਾਂ ਬੱਚਿਆਂ ਨੂੰ ਪੜਾ ਪੜ੍ਹਾਉਣ ਵੱਲ ਜ਼ਿਆਦਾ ਇੱਕ ਸਮਝਾਉਣਾ ਘੱਟ ਅਤੇ ਰੱਟੇ ਬਾਜ਼ੀ ਵਾਲ਼ਾ ਸਿਸਟਮ ਜ਼ਿਆਦਾ ਚੱਲਦਾ ਹੈ ਪ ਬਸ ਪੜ੍ਹੀ ਜਾਓ ਪੜ੍ਹੀ ਜਾਓ ਉਹਨੂੰ ਸਮਝਣੇ ਦੀ ਲੋੜ ਨਹੀਂ ਪੈਂਦੀ ਉਰੇੇ ਭਾਰਤ ਵਿੱਚ ਭਾਰਤ ਦੇ ਹੋਰ ਕੋਈ ਵੀ ਮੰਨ ਲਓ ਦੇ ਭਾਰਤ ਦੇ ਪ੍ਰਦੇਸ਼ ਹੋ ਗਏ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਕਿਤੇ ਵੀ ਹੈ ਬਸ ਸਿਸਟਮ ਪ੍ਰਣਾਲੀ ਕੋਈ ਸਹੀ ਤਰੀਕੇ ਨਾਲ ਚੱਲ ਨਹੀਂ ਰਹੀ ਹੈਗੀ ਸਿੱਖਿਆ ਮੰਤਰੀ ਜੇ ਦੇਖਿਆ ਜਾਵੇ ਭਾਰਤ ਦੇ ਜ਼ਿਆਦਾਤਰ ਅਨਪੜ੍ਹੇ ਬੈਠੇ ਹੈ ਉਹਨਾਂ ਨੂੰ ਜ਼ਿਆਦਾਤਰ ਪਤਾ ਸਤਾ ਨਹੀਂ ਹੈ ਕੁਛ ਵੀ ਕਿਵੇਂ ਕੀ ਲਾਗੂ ਕਰਨਾ ਕਿਵੇਂ ਸਿਸਟਮ ਚਲਾਉਣਾ ਕੋਈ ਪੇਪਰ ਵੀ ਹੁੰਦਾ ਪ੍ਰੀਖਿਆ ਵੀ ਹੁੰਦੀ ਆ ਉਹ ਵੀ ਬਸ ਧੱਕੇ ਜਿਹੇ ਨਾਲ ਹੀ ਚਲਾਉਂਦੇ ਹੈ ਇਸ ਲਈ ਸਟੂਡੈਂਟ ਬਾਹਰ ਜਾ ਕੇ ਜ਼ਿਆਦਾ ਪੜ੍ਹਨਾ ਵਧੀਆ ਬਿਹਤਰ ਸਮਝਦੇ ਆ